ਅੱਜ ਕੱਲ੍ਹ ਦੇ ਬੱਚੇ ਜ਼ਿਆਦਾ ਇਨਡੋਰ ਖੇਡਾਂ ਹੀ ਖੇਡਣੀਆਂ ਪਸੰਦ ਕਰਦੇ ਹਨ ਜਿਵੇਂ ਕਿ ਟੇਬਲ ਟੈਨਿਸ ਬੈਡਮਿੰਟਨ ਸ਼ਤਰੰਜ ਕੈਰਮ ਬੋਰਡ ਲੁਕਾ ਛੁਪੀ ਆਦਿ ਖੇਡਾਂ ਖੇਡਣੀਆਂ ਪਸੰਦ ਕਰਦੇ ਹਨ ਕਿਉਂਕਿ ਪੁਰਾਣੀਆਂ ਰਵਾਇਤੀ ਖੇਡਾਂ ਜਿਵੇਂ ਕੁਸ਼ਤੀ ਕਬੱਡੀ ਹਾਕੀ ਫੁੱਟਬਾਲ ਕ੍ਰਿਕਟ ਵਿੱਚ ਸਰੀਰਕ ਤਾਕਤ ਬਹੁਤ ਲੱਗਦੀ ਹੈ ਅਤੇ ਬੱਚੇ ਇਨ੍ਹਾਂ ਖੇਡਾਂ ਤੋਂ ਦੂਰ ਹੁੰਦੇ ਜਾ ਰਹੇ ਹਨ ਜਾਂ ਬੱਚੇ ਫੋਨ ਦੇ ਉੱਪਰ ਹੀ ਵੀਡੀਓ ਗੇਮਾਂ ਖੇਡਣੀਆਂ ਜ਼ਿਆਦਾ ਪਸੰਦ ਕਰਦੇ ਹਨ ਅੱਜ ਕੱਲ੍ਹ ਫੋਨ ਦੇ ਵਿੱਚ ਹੀ ਸ਼ਤਰੰਜ ਦੀ ਖੇਡ ਵੀ ਖੇਡੀ ਜਾ ਸਕਦੀ ਹੈ ਅਤੇ ਹੋਰ ਦੂਸਰੀਆਂ ਖੇਡਾਂ ਜਿਵੇਂ ਕੈਰਮ ਬੋਰਡ ਲੁੱਡੋ ਕ੍ਰਿਕਟ ਹਾਕੀ ਫਿਰੀ ਫਾਇਰ ਆਦਿ ਖੇਡਾਂ ਖੇਡੀਆਂ ਜਾ ਸਕਦੀਆਂ ਅਤੇ ਇਹ ਸਾਰੀਆਂ ਨਵੀਆਂ ਖੇਡਾਂ ਬੱਚੇ ਅੱਜ ਕੱਲ੍ਹ ਖੇਡ ਰਹੇ ਹਨ